ਖੁੱਲ੍ਹੇ ਪਾਣੀ ਵਿੱਚ ਜਦੋਂ ਆਪਾਂ ਤੈਰਾਕੀ ਕਰਦੇ ਹਾਂ ਤਾਂ ਸੁਰੱਖਿਤ ਰਹਿਣ ਲਈ ਸਭ ਤੋਂ ਮੁੱਖ ਚੀਜ਼ ਇਹ ਹੈ ਕਿ ਸਾਨੂੰ ਉਸ ਖੁੱਲ੍ਹੇ ਪਾਣੀ ਦੀ ਡੁੰਘਾਈ ਗਹਿਰਾਈ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਜਿਵੇਂ ਜਿਵੇਂ ਅਸੀਂ ਖੁੱਲ੍ਹੇ ਪਾਣੀ ਵਿੱਚ ਅੱਗੇ ਅੱਗੇ ਵਧਦੇ ਹਾਂ ਤਾਂ ਇਹ ਵੀ ਨਾਲ ਸਿੱਧ ਹੋ ਜਾਂਦਾ ਹੈ ਕਿ ਉਹਦੀ ਡੁੰਗਾਈ ਵੀ ਵਧਦੀ ਜਾਂਦੀ ਹੈ ਅਤੇ ਅਗਰ ਅਸੀਂ ਤੈਰਾਕੀ ਵਿੱਚ ਜ਼ਿਆਦਾ ਨਿਪੁੰਨ ਨਹੀਂ ਹਾਂ ਅਸੀਂ ਨਹੀਂ ਜ਼ਿਆਦਾ ਜਾਣਦੇ ਤਾਂ ਸੰਭਾਵਨਾ ਇਹ ਹੈ ਕਿ ਅਸੀਂ ਡੁੱਬ ਵੀ ਸਕਦੇ ਹਾਂ ਇਸ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਡੂੰਘਾਈ ਦਾ ਪਤਾ ਹੋਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਸਾਡੇ ਨਾਲ ਸਾਡਾ ਕੋਈ ਦੋਸਤ ਮਿੱਤਰ ਜਾਂ ਘਰ ਦਾ ਵਿਅਕਤੀ ਜ਼ਰੂਰ ਸੰਪਰਕ ਵਿੱਚ ਹੋਵੇ ਕਿਉਂਕਿ ਅਗਰ ਮੰਨ ਲਓ ਅਸੀਂ ਕੁਛ ਦਿੱਕਤ ਮਹਿਸੂਸ ਕਰਦੇ ਹਾਂ ਅਤੇ ਸਾਡੀ ਸਹਾਇਤਾ ਲਈ ਉਹ ਤੁਰੰਤ ਸਾਡੇ ਨਾਲ ਆ ਸਕੇ ਅਤੇ ਬਾਕੀ ਇਹ ਹੈ ਕਿ ਜਿੱਥੇ ਤਿਲਕਣ ਵਾਲੀ ਜਗ੍ਹਾ ਹੁੰਦੀ ਹੈ ਉੱਥੇ ਸਾਨੂੰ ਅਗਰ ਕੋਈ ਕਾਈ ਹੈ ਲੱਗੀ ਕਿਤੇ ਐਲਗੀ ਜਾਂ ਕੋਈ ਤੇਜ਼ ਬਹਾਵ ਹੈ ਅਤੇ ਉੱਥੇ ਇਹ ਸੰਭਾਵਣਾ ਨਿਸ਼ਚਿਤ ਬਣੀ ਰਹਿੰਦੀ ਹੈ ਕਿ ਅਸੀਂ ਡਿੱਗ ਸਕਦੇ ਹਾਂ ਸਾਨੂੰ ਚੋਟ ਵੀ ਲੱਗ ਸਕਦੀ ਹੈ ਇਸ ਲਈ ਉੱਥੇ ਜਿੰਨਾ ਹੋ ਸਕੇ ਅਸੀਂ ਅਵੋਇਡ ਕਰੀਏ ਅਸੀਂ ਨਾ ਉੱਥੇ ਜਾ ਕਰਕੇ ਤੈਰਾਕੀ ਦਾ ਅਭਿਆਸ ਕਰੀਏ ਸਾਨੂੰ ਉੱਥੇ ਜਾਣ ਤੋਂ ਬਚਣਾ ਚਾਹੀਦਾ ਧੰਨਵਾਦ